ਪੰਜਾਬ ਵਿੱਚ ਬਹੁਤ ਸਾਰੇ ਕਮੇਡੀ ਕਲੱਬ ਹਨ ਬਹੁਤ ਸਾਰੇ ਕਮੇਡੀ ਈਵੈਂਟ ਹੁੰਦੇ ਹਨ ਇਹਨਾਂ ਦਾ ਮੁੱਖ ਕੰਮ ਹੈ ਹਸਾਉਣਾ ਇਹ ਪ੍ਰਦਰਸ਼ਨਕਾਰ ਇੰਨਾ ਵਧੀਆ ਪ੍ਰਦਰਸ਼ਨ ਕਰਦੇ ਹਨ ਕਿ ਹੱਸਾ ਕੇ ਰੱਖ ਦਿੰਦੇ ਹਨ ਮਨ ਖੁਸ਼ ਕਰ ਦਿੰਦੇ ਹਨ ਜਿਵੇਂ ਕਿ ਕਿਸੇ ਦਾ ਮਨ ਉਦਾਸ ਹੋਏ ਕੋਈ ਸਟਰੈਸ ਵਿੱਚ ਹੋਵੇ ਤਾਂ ਇਹਨਾਂ ਦੇ ਈਵੈਂਟ ਦੇਖ ਕੇ ਆਪਣਾ ਮਨ ਸਹੀ ਕਰ ਸਕਦਾ ਹੈ ਇਹ ਬਹੁਤ ਹੀ ਮਨ ਨੂੰ ਸੰਤਸ਼ੁਟੀ ਦਿੰਦੇ ਹਨ ਮਨ ਨੂੰ ਹਸਾ ਕੇ ਤਰੋ ਤਾਜ਼ਾ ਕਰ ਦਿੰਦੇ ਹਨ ਜਿਵੇਂ ਕਿ ਮਨਪ੍ਰੀਤ ਸਿੰਘ ਬਹੁਤ ਸਾਰੀ ਈਵੈਂਟ ਹਨ ਜਿਵੇਂ ਮਨਪ੍ਰੀਤ ਸਿੰਘ ਦਾ ਸਹੀ ਗੱਲ ਆ ਸਟੈਂਡਅਪ ਕੋਮੇਡੀ ਕਰਦੇ ਹਨ ਜਾਨੇ ਕਿਸੀ ਕੋ ਮਤ ਬਤਾਨਾ ਕਿਸੀ ਕੋ ਮਤ ਬਤਾਨਾ ਅਨੁਭਵ ਸਿੰਘ ਦਾ ਇੱਕ ਪ੍ਰਦਰਸ਼ਨਕਾਰ ਹਨ ਜਿਸ ਤਰ੍ਹਾਂ ਕਿ ਟੋਕਸਿਕ ਅੰਮ੍ਰਿਤਸਰ ਕੀ ਈਵੈਂਟ ਹੁੰਦਾ ਹੈ ਅਭਿਸ਼ੇਕ ਅਭਿਮਨਿਊ ਦਾ ਉਪਮਨਿਊ ਦਾ ਗ ਗੌਰਵ ਗੁਪਤਾ ਦਾ ਆਉਂਦਾ ਵਾ ਚਲਤਾ ਹੈ ਕੋਮੇਡੀ ਆਉਂਦਾ ਹੈ ਜਿਵੇਂ ਕੋਮੇਡੀ ਲੈਡਰ ਆਉਂਦਾ ਹੈ ਜਿਵੇਂ ਕਿ ਕਪਿਲ ਸ਼ਰਮਾ ਸੀਗਾ ਕਪਿਲ ਸ਼ਰਮਾ ਦਾ ਸ਼ੋਅ ਆਉਂਦਾ ਬਹੁਤ ਹੀ ਹਸਾਉਂਦਾ ਹੈ ਭਾਰਤੀ ਵੀ ਪੰਜਾਬ ਦੀ ਅੰਮ੍ਰਿਤਸਰ ਤੋਂ ਗਈ ਹੈ ਕਪਿਲ ਸ਼ਰਮਾ ਵੀ ਇਹ ਬਹੁਤ ਹੀ ਪ੍ਰਦਰਸ਼ਨਕਾਰ ਸਟੈਂਡਅਪ ਵਧੀਆ ਕੋਮੇਡੀ ਕਰਦੇ ਹਨ ਇਹਨਾਂ ਨੇ ਖਾਲਸਾ ਕਾਲਜ ਦੇ ਸਾਹਮਣੇ ਨਾਟਸ਼ਾਲਾ ਵਿੱਚ ਬਹੁਤ ਹੀ ਕੰਮ ਵਧੀਆ ਕੀਤਾ ਹੈ ਅਤੇ ਬਹੁਤ ਹੀ ਲੋਕਾਂ ਨੂੰ ਹਸਾਇਆ ਹੈ ਇਹਨਾਂ ਇਹ ਬਹੁਤ ਹੀ ਵਧੀਆ ਪ੍ਰਦਰਸ਼ਨਕਾਰ ਹਨ ਇਹਨਾਂ ਦਾ ਮੁੱਖ ਕੰਮ ਮੰਤਵ ਹੁੰਦਾ ਹੈ ਲੋਕਾਂ ਨੂੰ ਹਸਾਉਣਾ ਇਹ ਸਟੈਂਡਅਪ ਕੋਮੇਡੀ ਕਰਦੇ ਹਨ ਜੋ ਕਿ ਸਾਡੀ ਆਮ ਜ਼ਿੰਦਗੀ ਵਿੱਚ ਹੁੰਦਾ ਹੈ ਉਹ ਉਸ ਨੂੰ ਗੱਲਾਂ ਨੂੰ ਰੋਸਟ ਕਰਕੇ ਪ੍ਰਦਰਸ਼ਨ ਕਰਦੇ ਹਨ ਅਤੇ ਇਹ ਅੱਜ ਕੱਲ੍ਹ ਬਹੁਤ ਹੀ ਵਧੀਆ ਪ੍ਰਦਰਸ਼ਨਕਾਰ ਬਣ ਗਏ ਹਨ ਹੋਰ ਵੀ ਬਹੁਤ ਸਾਰੇ ਈਵੈਂਟ ਹਨ ਇਹਨਾਂ ਦਾ ਮੁੱਖ ਮੰਤਵ ਹੁੰਦਾ ਹੈ ਪ੍ਰਦਰਸ਼ਨਕਾਰੀਆਂ ਦਾ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਕੇ ਇਹਨਾਂ ਦਾ ਮੰਤਵ ਹੈ ਪ੍ਰਦਰਸ਼ਨ ਕਰਕੇ ਮਨ ਨੂੰ ਖੁਸ਼ ਕਰਨਾ ਅਤੇ ਟਾਈਮ ਨੂੰ ਖੁਸ਼ਹਾਲ ਬਣਾ ਦਿੰਦੇ ਹਨ ਧੰਨਵਾਦ